ਹਾਂਜੀ ਰਵੀ ਭਾਅ ਜੀ ਕੀ ਹਾਲ ਚਾਲ ਹੈ ਜੀ ਉਹ ਭਾਅ ਜੀ ਮੈਂ ਤੁਹਾਡੇ ਕੋਲੋ ਇੱਕ ਜੈਕਟ ਮੰਗਵਾਈ ਸੀਗੀ ਹਾਂ ਪੰਦਰ੍ਹਾਂ ਦਿਨ ਪਹਿਲਾਂ ਉਹ ਭਾਅ ਜੀ ਉਹ ਜੈਕਟ ਮੈਂ ਬਲੈਕ ਕਲਰ 'ਚ ਮੰਗਵਾਈ ਸੀਗੀ ਤੁਸੀਂ ਭੇਜ ਦਿੱਤੀ ਬਲਊ ਕਲਰ 'ਚ ਹਾਂ ਔਨਲਾਈਨ ਪਾਰਸਲ ਮੰਗਵਾਇਆ ਵਾ ਔਨਲਾਈਨ ਏ ਆਈ ਸੀਗੀ ਅਤੇ ਤੁਹਾਡਾ ਪਾਰਸਲ ਵੀ ਲੇਟ ਹੋ ਗਿਆ ਉਹ ਹੈ ਜਿਸ ਦਿਨ ਮੈਂ ਮੈਰਿਜ ਜਾਣਾ ਗਾ ਉਸੇ ਦਿਨ ਮੇਰੇ ਕੋਲ ਇੱਕ ਦਿਨ ਪਹਿਲਾਂ ਹੀ ਪਾਰਸਲ ਪਹੁੰਚਿਆ ਤੁਹਾਡਾ ਅਤੇ ਉਹ ਜਦੋਂ ਖੋਲ੍ਹ ਕੇ ਦੇਖੀ ਤਾਂ ਉਹ ਕਲਰ ਦਾ ਫਰਕ ਪੈ ਰਿਹਾ ਹੈਗਾ ਅਤੇ ਭਾਅ ਜੀ ਇਸ ਤਰ੍ਹਾਂ ਬਹੁਤ ਗ਼ਲਤ ਗੱਲ ਹੈ ਤੁਹਾਡੇ ਬਾਰੇ ਕਿਉਂਕਿ ਬੰਦੇ ਨੇ ਕਿਤੇ ਜਾਣਾ ਹੁੰਦਾ ਜਾਂ ਕੁਝ ਹੈ ਤਾਂ ਐਮਰਜੈਂਸੀ ਹੀ ਮੰਗਾਉਂਦਾ ਕੋਈ ਸਮਾਨ ਅਤੇ ਮੇਰੇ ਮੈਰਿਜ ਜਿੱਥੇ ਜਾਣਾ ਹੈਗਾ ਉੱਥੇ ਇੱਕ ਦਿਨ ਦਾ ਗੈਪ ਸੀਗਾ ਮੈਨੂੰ ਔਨਲਾਈਨ ਫਿਰ ਉਹ ਬਹੁਤ ਗ਼ਲਤ ਲੱਗਿਆ ਤੁਹਾਡਾ ਸਿਸਟਮ ਜਿਹੜਾ ਤੁਸੀਂ ਗ਼ਲਤ ਭੇਜਤਾ ਨਹੀਂ ਹੈ ਤਾਂ ਤੁਸੀਂ ਕੈਂਸਲ ਕਰ ਦਿੰਦੇ ਰਿਜੈਕਟ ਕਰ ਦਿੰਦੇ ਕਿ ਉਹ ਕਲਰ ਨਹੀਂ ਹੈ ਇਸ ਕਰਕੇ ਮੈਨੂੰ ਬਜ਼ਾਰ 'ਚ ਮੌਕੇ ਪਰ ਜਾ ਕੇ ਹੀ ਲੈਣੀ ਪਈ ਅਤੇ ਮੈਰਿਜ ਮੈਂ ਬੜੀ ਮੁਸ਼ਕਿਲ ਨਾਲ ਅਟੈਂਡ ਕੀਤੀ ਕਰ ਕੀਤੀ ਹੈ ਫਿਰ ਇਸ ਤਰ੍ਹਾਂ ਭਾਅ ਜੀ ਅੱਗੇ ਤੋਂ ਕਿਸੇ ਹੋਰ ਕਸਟਮਰ ਨਾਲ ਨਾ ਕਰਿਆ ਕਰੋ ਮੈਂ ਤਾਂ ਪਹਿਲਾਂ ਵੀ ਤੁਹਾਡਾ ਪੁਰਾਣਾ ਕਸਟਮਰ ਹੈ ਪਹਿਲਾਂ ਵੀ ਤੁਹਾਡੇ ਕੋਲੋਂ ਬੈਲਟਾਂ ਵੀ ਦੋ ਚਾਰ ਮੰਗਾਈਆਂ ਅਤੇ ਸ ਬੂਟ ਵੀ ਮੰਗਾਏ ਆ ਉਹ ਠੀਕ ਨਿਕਲੇ ਉਹਨਾਂ ਵਿੱਚ ਕੋਈ ਕਮੀਂ ਨਹੀਂ ਸੀਗੀ ਪਰ ਜਿਹੜੀ ਤੁਸੀਂ ਮੈਨੂੰ ਇਸ ਵਾਰ ਲਾਸਟ ਵਿੱਚ ਜੈਕਟ ਭੇਜੀ ਹੈ ਉਹ ਬਹੁਤ ਗ਼ਲਤ ਨਿਕਲੀ ਹੈ ਮੈਂ ਉਹ ਵਾਪਸ ਤੁਹਾਨੂੰ ਕਰਨੀ ਚਾਹੁੰਦਾ ਤੁਹਾਨੂੰ ਆ ਕੇ ਦਿਖਾ ਕੇ ਵੀ ਜਾਊਂਗਾ ਤੁਸੀਂ ਦੇਖ ਵੀ ਲਿਓ ਚੈੱਕ ਕਰ ਲਿਓ ਕਿ ਉਹਦੇ ਵਿੱਚ ਹੈ ਪ੍ਰੋਬਲਮ ਔਰ ਕਲਰ ਦੀ ਮੇਨ ਪ੍ਰੋਬਲਮ ਆ ਗਈ ਕਲਰ ਮੈਂ ਜਿਹੜਾ ਮੰਗਾਇਆ ਭੇਜਿਆ ਨਹੀਂ ਤੁਸੀਂ ਕਲਰ ਗ਼ਲਤ ਭੇਜ ਦਿੱਤਾ ਹੈਗਾ ਠੀਕ ਹੈ ਠੀਕ ਹੈ ਮੈਂ ਆਉਂਗਾ ਇੱਕ ਦੋ ਦਿਨ ਤੱਕ ਤੁਹਾਨੂੰ ਦਿਖਾ ਕੇ ਜਾਊਂਗਾ ਫਿਰ ਤੁਸੀਂ ਦੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਗ਼ਲਤ ਹੈ ਇਹ ਚੀਜ਼ ਇਹ